ਅੱਜ ਕੱਲ੍ਹ ਦੇ ਸਮੇਂ ਵਿੱਚ ਫਲਾਂ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੋ ਗਿਆ ਹੈਗਾ ਹੈ ਅਤੇ ਜਿਵੇਂ ਉਹਦੇ ਵਿੱਚ ਕੀਵੀ ਫਲ ਦਾ ਬਹੁਤ ਜ਼ਿਆਦਾ ਯੋਗਦਾਨ ਹੋ ਰਿਹਾ ਆ ਇਹਦੇ ਵਿੱਚ ਇਹ ਹੈਗਾ ਕਿ ਜਿੱਦਾਂ ਬੱਚਿਆਂ ਦੇ ਸੈੱਲ ਸੁੱਲ ਕਿਸੇ ਦੇ ਘੱਟ ਜਾਣ ਤਾਂ ਕੀਵੀ ਉਹਦੇ ਲਈ ਠੀਕ ਰਹਿੰਦਾ ਅਤੇ ਜਿਵੇਂ ਕਿਸੇ ਦੀ ਸ਼ੂਗਰ ਵਧੀ ਹੋਵੇ ਉਹ ਵੀ ਇਹਦੇ ਵਿੱਚ ਵੀ ਸਹੀ ਹੈਗਾ ਆ ਕੀਵੀ ਕਾਫੀ ਜ਼ਿਆਦਾ ਹੁਣ ਲੋਕ ਵਰਤਣ ਲੱਗ ਗਏ ਹਨ ਅਤੇ ਮਹਿੰਗਾ ਵੀ ਫਲ ਹੈਗਾ ਆ ਇੱਕ ਵਾਰੀ ਮੇਰੀ ਬੇਟੀ ਇੱਦਾਂ ਹੀ ਬਿਮਾਰ ਹੋ ਗਈ ਸੀਗੀ ਅਤੇ ਉਹਨੂੰ ਡੋਕਟਰਾਂ ਨੇ ਇਹੀ ਸਲਾਹ ਦਿੱਤੀ ਸੀ ਵੀ ਕੀਵੀ ਫਲ ਜਾਂ ਨਾਰੀਅਲ ਦਿਓ ਜ਼ਿਆਦਾ ਅਸੀਂ ਕੀਵੀ ਫਲ ਹੀ ਖਿਲਾਏ ਅਤੇ ਉਹਦੇ ਨਾਲ ਕਾਫੀ ਇਹਨੂੰ ਫਰਕ ਪਿਆ ਉਦੋਂ ਦਾ ਅਸੀਂ ਮਤਲਬ ਘਰ ਦੇ ਵਿੱਚ ਫਰੂਟ ਦੇ ਵਿੱਚ ਜ਼ਰੂਰ ਕੀਵੀ ਫਲ ਹੁੰਦਾ ਹੈ ਸਾਡੇ ਤਾਂ ਹੋਰ ਜੂਸ ਵੀ ਬੱਚੇ ਕਈ ਵਾਰੀ ਕੱਢ ਲੈਂਦੇ ਆ ਹੋਰ ਬੱਸ ਸਾਰਿਆਂ ਲਈ ਠੀਕ ਹੈ